ਹੈਲੋ ਤੁਸੀਂ ਸਿਮਰਨ ਵੈਜੀਟੇਬਲ ਸੈਲਰ ਤੋਂ ਬੋਲ ਰਹੇ ਹੋ ਮੇਰੀ ਸਿਸਟਰ ਦੀ ਮੈਰਿਜ ਆ ਅਤੇ ਉਹਦੇ ਲਈ ਸਾਨੂੰ ਵੈਜੀਟੇਬਲ ਚਾਹੀਦੀਆਂ ਨੇ ਅਤੇ ਤੁਸੀਂ ਮੈਨੂੰ ਵੈਜੀਟੇਬਲ ਦੇ ਪ੍ਰਾਈਜ ਦੱਸੋਗੇ ਹਾਂਜੀ ਆਲੂ ਪਿਆਜ ਟਮਾਟਰ ਹਰੀ ਮਿਰਚਾਂ ਪੱਤਾ ਗੋਭੀ ਫੁੱਲ ਗੋਭੀ ਸ਼ਿਮਲਾ ਮਿਰਚ ਲਸਣ ਅਦਰਕ ਠੀਕ ਹੈ ਅਤੇ ਹੋਰ ਵੀ ਕਈ ਚੀਜ਼ਾਂ ਚਾਹੀਦੀਆਂ ਨੇ ਅਤੇ ਤੁਸੀਂ ਮੈਨੂੰ ਉਹਨਾਂ ਦਾ ਰੇਟ ਦੱਸੋਗੇ ਅੱਛਾ ਹਮ ਹਮ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਮੈਨੂੰ ਪੱਤਾ ਗੋਭੀ ਦਸ ਕਿਲੋ ਚਾਹੀਦੀ ਹੈ ਦਸ ਕਿਲੋ ਹੀ ਦੂਜੀ ਗੋਭੀ ਚਾਹੀਦੀ ਹੈ ਫੁੱਲ ਗੋਭੀ ਅਤੇ ਪੰਜ ਕਿਲੋ ਸ਼ਿਮਲਾ ਮਿਰਚ ਚਾਹੀਦੀ ਨੇ ਅਤੇ ਟਮਾਟਰ ਚਾਹੀਦੇ ਨੇ ਅੱਠ ਕਿਲੋ ਅਤੇ ਵੀਹ ਕਿਲੋ ਆਲੂ ਚਾਹੀਦੇ ਨੇ ਵੀਹ ਕਿਲੋ ਵੀਹ ਪਿਆਜ਼ ਚਾਹੀਦੇ ਨੇ ਠੀਕ ਆ ਅਤੇ ਪੰਜ ਕਿਲੋ ਹਰੀ ਮਿਰਚਾਂ ਚਾਹੀਦੀਆਂ ਨੇ ਠੀਕ ਹੈ ਅਤੇ ਤੁਹਾਡੀ ਪ੍ਰਾਈਜ ਲਿਸਟ ਤੁਸੀਂ ਮੈਨੂੰ ਐਸ ਐਮ ਐਸ ਕਰ ਸਕਦੇ ਹੋ ਠੀਕ ਆ ਠੀਕ ਆ ਜੀ ਠੀਕ ਹੈ ਜੀ ਥੈਂਕ ਯੂ